ਕੁਕਿੰਗ ਇੱਕ ਬਹੁਤ ਅੱਛੀ ਚੀਜ਼ ਹੈ ਆਪਾਂ ਨੂੰ ਕੁਕਿੰਗ ਸਿੱਖਣੀ ਚਾਹੀਦੀ ਹੈ ਕੁਕਿੰਗ ਦੇ ਅੱਜ ਕੱਲ੍ਹ ਬਹੁਤ ਸਕੂਲ ਖੁੱਲ੍ਹ ਚੁੱਕੇ ਹੈ ਜਿੱਥੇ ਆਪਾਂ ਨੂੰ ਕੁਕਿੰਗ ਬਹੁਤ ਤ ਤਰ੍ਹਾਂ ਦੀ ਕੁਕਿੰਗ ਸਿਖਾਈ ਜਾਂਦੀ ਹੈ ਮੈਂ ਖੁਦ ਵੀ ਕੁਕਿੰਗ ਸਿੱਖੀ ਹੈ ਬਾਹਰ ਔਰ ਮੈਨੂੰ ਬਹੁਤ ਅੱਛਾ ਲੱਗਦਾ ਕੁੱਕ ਕਰਨਾ ਜਿਸ ਤਰ੍ਹਾਂ ਆਪਾਂ ਕੁਛ ਵੀ ਬ ਘਰੇ ਬਣਾਉਦੇ ਹਾਂ ਕੋਈ ਵੀ ਫੂਡ ਜਿਸ ਤਰ੍ਹਾਂ ਪੰਜਾਬੀ ਫੂਡ ਲਗਾ ਲਉ ਜਾਂ ਸਾਊਥ ਇੰਡੀਅਨ ਮੈਨੂੰ ਡੋਸਾ ਬਣਾਉਣਾ ਬਹੁਤ ਪਸੰਦ ਹੈ ਉਸ ਤੋਂ ਇਲਾਵਾ ਪੰਜਾਬੀ ਫੂਡ ਬਣਾਉਣਾ ਮੈਨੂੰ ਬਹੁਤ ਪਸੰਦ ਹੈ ਜਿਸ ਤਰ੍ਹਾਂ ਅੰਮ੍ਰਿਤਸਰੀ ਕੁਲਚੇ ਵਗੈਰਾ ਮੈਂ ਘਰੇ ਹੀ ਬਣਾਉਦੀ ਹਾਂ ਔਰ ਬਟ ਸਭ ਨੂੰ ਕੁਕਿੰਗ ਸਿੱਖਣੀ ਚਾਹੀਦੀ ਹੈ ਸੋ ਕੁਕਿੰਗ ਬਹੁਤ ਅੱਛੀ ਹੈ ਅੱਗੇ ਨੂੰ ਆਪਾਂ ਕੁਕਿੰਗ ਦੇ ਬੇਸ 'ਤੇ ਆਪਣੀ ਲਾਈਫ ਵੀ ਸੈੱਟ ਕਰ ਸਕਦੇ ਹਾਂ ਕੁਕਿੰਗ 'ਚ ਆਪਾਂ ਅੱਗੇ ਵਧ ਸਕਦੇ ਆਪਣੇ ਹੋਟਲ ਵਗੈਰਾ ਖੋਲ੍ਹ ਸਕਦੇ ਹਾਂ ਕੁਕਿੰਗ ਕੁਕਿੰਗ ਦਾ ਕੋਰਸ ਕਰਕੇ ਆਪਾਂ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਸਕਦੇ ਹਾਂ ਔਰ ਕੁਕਿੰਗ ਦੇ ਨਾਲ ਆਪਾਂ ਕਾਫੀ ਅੱਗੇ ਤੱਕ ਜਾ ਸਕਦੇ ਕੁਕਿੰਗ ਇੱਕ ਬਹੁਤ ਅੱਛੀ ਚੀਜ਼ ਹੈ ਕੁਕਿੰਗ ਸਭ ਨੂੰ ਸਿੱਖਣੀ ਚਾਹੀਦੀ ਹੈ ਔਰ ਜ਼ਰੂਰ ਸਿੱਖੋ ਔਰ ਕੁਕਿੰਗ ਵਾਸਤੇ ਬਹੁਤ ਅੱਛੇ ਅੱਛੇ ਸਕੂਲ ਖੁੱਲ੍ਹ ਚੁੱਕੇ ਹਨ ਆਪਾਂ ਨੂੰ ਉਹਨਾਂ ਸਕੂਲਾਂ 'ਚ ਜਾ ਕੇ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ